ਹਾਂ ਮੈਂ ਸੰ ਸਮੱਗਰੀ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਅਤੇ ਅਨੁਭਵ ਲਾਭਦਾਇਕ ਅਤੇ ਸੂਝ ਭਰਪੂਰ ਰਿਹਾ ਹੈ ਪੰਜਾਬੀ ਆਪਣੀ ਅਮੀਰ ਭਾਸ਼ਾਈ ਅਤੇ ਸੱਭਿਆਚਾਰਕ ਸੂਖਮਤਾ ਦੇ ਨਾਲ ਇਹ ਯਕੀਨੀ ਬਣਾਉਣ ਲਈ ਧਿਆਨ ਨਾਲ ਧਿਆਨ ਦੇਣ ਦੀ ਲੋੜ ਹੈ ਕਿ ਅਨੁਵਾਦ ਸਹੀ ਅਰਥਾਂ ਨੂੰ ਵਿਅਕਤ ਕਰਦੇ ਹਨ ਅਤੇ ਮੂਲ ਬੋਲਣ ਵਾਲਿਆਂ ਨਾਲ ਗੂੰਜਦੇ ਹਨ ਮੈਂ ਤਕਨੀਕੀ ਦਸਤਾਵੇਜ਼ਾਂ ਤੋਂ ਲੈ ਕੇ ਰਚਨਾਤਮਕ ਲਿਖਤ ਤੱਕ ਵੱਖ ਵੱਖ ਕਿਸਮ ਦੀਆਂ ਕਿਸਮ ਦੀ ਸਮੱਗਰੀ 'ਤੇ ਕੰਮ ਕੀਤਾ ਹੈ ਅਤੇ ਹਰੇਕ ਦੀਆਂ ਆਪਣੀਆਂ ਚੁਣੌਤੀਆਂ ਹਨ ਜਿਵੇਂ ਕਿ ਮੁਹਾਵਰੇ ਵਾਲੇ ਸਮੀਕਰਨ ਅਤੇ ਸੱਭਿਆਚਾਰਕ ਸੰਦਰਭ ਪ੍ਰਕਿਰਿਆ ਵਿੱਚ ਅਕਸਰ ਪ੍ਰਸੰਗ ਵਿਸ਼ੇਸ਼ ਰੂਪਾਂਤਰਾਂ ਦੇ ਨਾਲ ਸ਼ਾਬਦਿਕ ਅਨੁਵਾਦਾਂ ਨੂੰ ਸੰਤੁਲਿਤ ਕਰਨਾ ਸ਼ਾਮਿਲ ਹੁੰਦਾ ਹੈ ਸਮੁੱਚੇ ਤੌਰ 'ਤੇ ਪੰਜਾਬੀ ਵਿੱਚ ਅਨੁਵਾਦ ਕਰਨ ਨੇ ਭਾਸ਼ਾ ਅਤੇ ਇਸਦੇ ਵਿਲੱਖਣ ਪ੍ਰਗਟਾਵੇ ਲਈ ਮੇਰੀ ਪ੍ਰਸ਼ੰਸਾ ਨੂੰ ਡੂੰਘਾ ਕੀਤਾ ਹੈ ਨਾਲ ਹੀ ਪ੍ਰਭਾਵਸ਼ਾਲੀ ਸੰਚਾਰ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ